ਭਾਰਤ ਵਿੱਚ ਪੁਰਾਤਨ ਸਮਿਆਂ ਵਿੱਚ ਔਰਤ ਨੂੰ ਖੇਡਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਉਸ ਨੂੰ ਘਰ ਦੇ ਵਿੱਚ ਕੰਮ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ ਅਤੇ ਹੁਣ ਇਸ ਟਾਇਮ ਔਰਤ ਨੂੰ ਬਰਾਬਰ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ ਕਿ ਔਰਤ ਨੇ ਤਰੱਕੀ ਵੀ ਕੀਤੀ ਹੈ ਸਾਡੇ ਇੱਥੋਂ ਦੇ ਬੋਕਸਿੰਗ ਦੇ ਪਲੇਅਰ ਵੀ ਬਹੁਤ ਵਧੀਆ ਨੇ ਇੰਟਰਨੈਸ਼ਨਲ ਲੈਵਲ ਤੱਕ ਗੋਲਡ ਮੈਡਲ ਵਿੱਚ ਉਹਨਾਂ ਨੇ ਮਾਰਾਂ ਮਾਰੀਆਂ ਹੋਈਆਂ ਪਹਿਲੇ ਪੱਧਰ 'ਤੇ ਆਉਂਦੇ ਹਨ ਔਰਤਾਂ ਨੇ ਆਹ ਸਾਬਤ ਕੀਤਾ ਹੈ ਨਾ ਕਿ ਉਹ ਕੇਵਲ ਘਰ ਦੇ ਕੰਮ ਕਰ ਸਕਦੀਆਂ ਨੇ ਉਹ ਬਾਹਰ ਵੀ ਇੰਨੀ ਹੀ ਤਰੱਕੀ ਕਰ ਸਕਦੀਆਂ ਹਨ ਇੱਕ ਸੁਲਤਾਨਾ ਡਰੀਮ ਨਾ ਦੀ ਕਿਤਾਬ ਵੀ ਲਿਖੀ ਗਈ ਸੀ ਉਸਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਨੂੰ ਦਰਸਾਇਆ ਗਿਆ ਹੈ ਕਿ ਔਰਤ ਕਿਸੇ ਤੋਂ ਘੱਟ ਨਹੀਂ ਉਹ ਆਪਣੇ ਆਪ ਨੂੰ ਸਾਬਤ ਕਰਨ ਲਈ ਸਾਰਾ ਕੁਝ ਕਰ ਸਕਦੀ ਹੈ ਕਿ ਔਰਤ ਨੂੰ ਕੁਲ ਦੇਵੀ ਦੱਸਿਆ ਗਿਆ ਹੈ ਅਤੇ ਕੁਲ ਦੇਵੀ ਕਿਸੇ ਤੋਂ ਘੱਟ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ ਔਰਤ ਨੂੰ ਵੈਸੇ ਵੀ ਸਨਮਾਨ ਬਹੁਤ ਦਿੱਤਾ ਜਾਂਦਾ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਉਹਨਾਂ ਨੂੰ ਰਾਜਿਆਂ ਦੀ ਮਾਂ ਦੱਸਿਆ ਗਿਆ ਹੈ ਅਤੇ ਜਿਹਨੇ ਐਡੇ ਐਡੇ ਗੁਰੂ ਸਾਹਿਬਾਨਾਂ ਨੂੰ ਜਨਮ ਦਿੱਤਾ ਹੈ ਉਹ ਔਰਤ ਘੱਟ ਨਹੀਂ ਹੋ ਸਕਦੀ